ਕਈ ਬੀਬੀਆਂ ਬੁ ਬੁਣਾਈ ਅਤੇ ਸਿਲਾਈ ਦਾ ਕੰਮ ਬਹੁਤ ਹੀ ਵਧੀਆ ਕਰਦੀਆਂ ਹਨ ਅਤੇ ਬੁਣਾਈ ਸਿਲਾਈ ਬਹੁਤ ਹੀ ਮਸ਼ਹੂਰ ਹੈ ਇੱਥੇ ਪੰਜਾਬੀ ਸੂਟ ਜ਼ਿਆਦਾ ਵਧੀਆ ਪਸੰਦ ਕਰਦੇ ਹਨ ਅਤੇ ਅਤੇ ਪਹਿਲਾਂ ਹੱਥਾਂ ਵਾਲੀ ਮਸ਼ੀਨ 'ਤੇ ਕੰਮ ਕਰਿਆ ਜਾਂਦਾ ਸੀ ਅਤੇ ਹੁਣ ਪੈਰਾਂ ਵਾਲੀ ਮਸ਼ੀਨ 'ਤੇ ਸਭ ਤੋਂ ਤੇਜ਼ੀ ਨਾਲ਼ ਕੰਮ ਕਰਿਆ ਜਾਂਦਾ ਹੈ ਜਿਸ ਨਾਲ਼ ਕਿ ਵਧੀਆ ਕੱਪੜੇ ਸੀਅ ਹੋ ਜਾਂਦੇ ਹਨ ਅਤੇ ਛੇਤੀ ਸੀਤੇ ਜਾਂਦੇ ਹਨ ਅਤੇ ਇੱਥੇ ਇੰਟਰਲੋਕ ਅਤੇ ਪੀਕੋ ਵਾਲੀ ਮਸ਼ੀਨ ਹੁਣ ਨਵੀਆਂ ਤਕ ਤ ਤਕਨੀਕਾਂ ਆ ਗਈਆਂ ਹਨ ਅਤੇ ਛੇਤੀ ਕੰਮ ਹੋ ਜਾਂਦੇ ਹਨ